ਹੈਲੋ ਕੀ ਤੁਸੀਂ ਦੁੱਖ ਨਿਵਾਰਨ ਸਾਹਿਬ ਪਟ ਪੰਜਾਬ ਵੱਲੋਂ ਪਟਿਆਲਾ ਤੋਂ ਗੱਲ ਕਰ ਰਹੇ ਹੋ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਸਿਮਰਪ੍ਰੀਤ ਸਿੰਘ ਹਾਂ ਮੈਂ ਆਪਣੀ ਮੈਂ ਆਪਣੇ ਆਪ ਨਾਲ ਆਪਣੀ ਟੀਮ ਨਾਲ ਜੋ ਕਿ ਪੰਦਰ੍ਹਾਂ ਵੀਹ ਜਾਣੇ ਹਨ ਸਾਊਥ ਇੰਡੀਆ ਤੋਂ ਪੰਜਾਬ ਵਿੱਚ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਵਿਜਿਟ ਕਰਨ ਵਾਸਤੇ ਆ ਰਿਹਾ ਹਾਂ ਕੀ ਤੁਸੀਂ ਮੈਨੂੰ ਇਸ ਬਾਰੇ ਕੁਛ ਜਾਣਕਾਰੀ ਦੇ ਸਕਦੇ ਹੋ ਮੈਨੂੰ ਤੁਸੀਂ ਮੈਨੂੰ ਤੁਸੀਂ ਇਹਦੇ ਰਹਿਣ ਬਾਰੇ ਬੁਕਿੰਗ ਬਾਰੇ ਕੀ ਸਿਸਟਮ ਹੈ ਉਹਦੇ ਬਾਰੇ ਜਾਣਕਾਰੀ ਦੇ ਸਕਦੇ ਹੋ ਕਿ ਰਹਿਣ ਬਾਰੇ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਹੈ ਜਾਂ ਕਿਵੇਂ ਐਂ ਅੱਛਾ ਜੀ ਅੱਛਾ ਜੀ ਅਤੇ ਹੋਰ ਕੁਛ ਮੈਨੂੰ ਇਹਦੀ ਮਰਿਆਦਾ ਬਾਰੇ ਜਾਂ ਫਿਰ ਮੈਨੂੰ ਸੇਵਾ ਕਰਨ ਬਾਰੇ ਤੁਸੀਂ ਕੀ ਦੱਸ ਸਕਦੇ ਓਂ ਠੀਕ ਹੈ ਜੀ ਅਤੇ ਚਲੋ ਠੀਕ ਹੈ ਜੀ ਵਧੀਆ ਤੁਹਾਡਾ ਬਹੁਤ ਧੰਨਵਾਦ ਹੈ ਮੈਂ ਪੰਦਰ੍ਹਾਂ ਤਰੀਕ ਪੰਦਰਾਂ ਜਨਵਰੀ ਦੋ ਹਜ਼ਾਰ ਚੌਵੀ ਨੂੰ ਪੰਜਾਬ ਆਵਾਂਗਾ ਅਤੇ ਮੈਂ ਆਉਂਦੇ ਸਾਰ ਤੁਹਾਨੂੰ ਫੋਨ ਕਰਾਂਗਾ ਠੀਕ ਹੈ ਜੀ ਧੰਨਵਾਦ ਠੀਕ ਹੈ ਜੀ